ਹਾਂਜੀ ਗਰਮੀ ਦੇ ਵਿੱਚ ਦੌੜਨ ਜਾਣ ਵਕਤ ਸਾਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਗਰਮੀ ਦੇ ਕਾਰਨ ਜਦੋਂ ਆਪਾਂ ਦੌੜਦੇ ਹਾਂ ਤਾਂ ਪਸੀਨਾ ਬਹੁਤ ਜ਼ਿਆਦਾ ਆਉਂਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਖੁੱਲ੍ਹੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ ਫਿਰ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਨਾਲ ਪਾਣੀ ਦੀ ਬੋਤਲ ਰੱਖੀਏ ਅਤੇ ਹੌਲੀ ਭੱਜੀਏ ਜਿਸ ਦੇ ਨਾਲ ਸਾਨੂੰ ਸਾਹ ਨਾ ਚੜ੍ਹੇ ਸਾਹ ਘੱਟ ਚੜ੍ਹੇਗਾ ਤਾਂ ਆਪਾਂ ਪਾਣੀ ਵੀ ਘੱਟ ਪੀਵਾਂਗੇ ਪਾਣੀ ਘੱਟ ਪੀਵਾਂਗੇ ਤਾਂ ਚੰਗਾ ਦੌੜਿਆ ਜਾਵੇਗਾ ਉਸੇ ਤਰ੍ਹਾਂ ਸਰਦੀ ਦੇ ਵਿੱਚ ਵੀ ਸਾਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅ ਦੌੜਨ ਸਮੇਂ ਅਸਾਨੂੰ ਮ ਟਾਈਮ ਦੇਖ ਕੇ ਘਰੋਂ ਜਾਣਾ ਚਾਹੀਦਾ ਹੈ ਕਿ ਸਰਦੀਆਂ ਦੇ ਵਿੱਚ ਸੁਬਹਾ ਵੀ ਧੁੰਦ ਹੁੰਦੀ ਹੈ ਅਤੇ ਸ਼ਾਮ ਨੂੰ ਵੀ ਧੁੰਦ ਹੁੰਦੀ ਹੈ ਕਿਉਂਕਿ ਕਈ ਵਾਰ ਆਪਾਂ ਧੁੰਦ 'ਚ ਦੌੜਦੇ ਹਾਂ ਤਾਂ ਸਾਹਮਣਿਓ ਅੱਗਿਓਂ ਆਉਂਦੀ ਚੀਜ਼ ਆਪਾਂ ਨੂੰ ਨਹੀਂ ਦਿਖਾਈ ਦਿੰਦੀ ਇਸ ਕਰਕੇ ਸਾਨੂੰ ਸਰਦੀਆਂ ਦੇ ਵਿੱਚ ਖਾਸ ਕਰਕੇ ਸਮੇਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਬਾਕੀ ਆਪਾਂ ਨੂੰ ਮੋਟੇ ਕੱਪੜੇ ਪਾ ਕੇ ਜਾਣਾ ਚਾਹੀਦਾ ਕਿ ਆਪਾਂ ਦੌੜਨ ਜਾਈਏ ਅਤੇ ਆਪਾਂ ਠੰਡ ਲਵਾ ਕੇ ਆ ਜਾਈਏ ਇਸ ਚੀਜ਼ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਬਰਸਾਤੀ ਮੌਸਮ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਤਾਂ ਪਹਿਲਾਂ ਆਪਾਂ ਨੂੰ ਆਪਣੇ ਬੂਟ ਧਿਆਨ ਨਾਲ ਪਾਉਣੇ ਚਾਹੀਦੇ ਹਨ ਕਿਉਂਕਿ ਬਰਸਾਤ ਹੋਣ ਕਰਕੇ ਸੜਕਾਂ ਗਿੱਲੀਆਂ ਹੁੰਦੀਆਂ ਹਨ ਤਿਲਕਣੀਆ ਵੀ ਹੁੰਦੀਆਂ ਹਨ ਇਸ ਕਰਕੇ ਸਾਨੂੰ ਇੱਦਾਂ ਦੇ ਬੂਟ ਪਾਉਣੇ ਚਾਹੀਦੇ ਹਨ ਜੋ ਗਿੱਲੇ ਫਰਸ਼ 'ਤੇ ਨਾ ਤਿਲਕਣ ਔਰ ਜੇ ਬਰਸਾਤ ਜ਼ਿਆਦਾ ਹੋ ਰਹੀ ਹੈ ਤਾਂ ਸਾਨੂੰ ਚਾਹੀਦਾ ਕਿ ਆਪਾਂ ਘਰੋਂ ਬਾਹਰ ਨਾ ਨਿਕਲੀਏ ਬਰਸਾਤ ਰੁਕਣ 'ਤੇ ਹੀ ਦੌੜਨ ਜਾਇਆ ਜਾਵੇ ਔਰ ਉਸ ਏਰੀਏ ਦੇ ਵਿੱਚ ਜਾਂ ਉਸ ਗਲੀਆਂ ਸੜਕਾਂ 'ਤੇ ਜਾਇਆ ਜਾਵੇ ਜਿੱਥੇ ਪਾਣੀ ਖੜ੍ਹਾ ਨਾ ਹੁੰਦਾ ਹੋਵੇ ਨਹੀਂ ਤਾਂ ਸਾਨੂੰ ਦੌੜਨ ਦੇ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ